ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਭਾਅ ਜੀ ਚੌਧਰੀ ਕੈਟਰਿੰਗਸ ਤੋਂ ਗੱਲ ਕਰ ਰਹੇ ਹੋ ਭਾਅ ਜੀ ਮੈਂ ਭਾਅ ਜੀ ਤੁਹਾਨੂੰ ਪੁੱਛਣਾ ਚਾਹੁੰਦਾ ਤਾ ਕਿ ਭਾਅ ਜੀ ਮੈਂ ਪੰਜਾਹ ਬੰਦਿਆਂ ਦਾ ਅਰੇਂਜਮੈਂਟ ਕਰਨਾ ਤਾ ਭਾਅ ਜੀ ਸਾਡੇ ਘਰ ਪਾਠ ਹੈ ਅਸੀਂ ਪੰਜਾਹ ਬੰਦਿਆ ਦਾ ਖਾਣ ਪੀਣ ਜਿੱਦਾਂ ਕਿ ਮਠਿਆਈ ਜਲੇਬੀਆਂ ਖੀਰ ਸ਼ਾਹੀ ਪਨੀਰ ਕੜੀ ਚੌਲ ਚੌਲ ਮਿੱਠੇ ਚੌਲ ਇਹ ਸਭ ਬਣਵਾਉਣੇ ਚਾਹੁੰਦਾ ਮੈਨੂੰ ਤੁਸੀਂ ਭਾਅ ਜੀ ਕਿ ਦੱਸ ਸਕਦੇ ਕਿ ਤੁਸੀਂ ਕਿਆ ਪ੍ਰਾਈਜ ਹੈ ਕਿਆ ਉਹ ਸਰ ਤੁਸੀਂ ਮੈਨੂੰ ਸਾਰਾ ਕੰਟੈਕਟ ਕਰਕੇ ਦੱਸ ਸਕਦੇ ਭਾਅ ਜੀ ਕਿਆ ਮੈਨੂੰ ਕਿੰਨਾ ਕੁ ਕਿਆ ਡਿਸਕਾਊਂਟ ਮਿਲੇਗਾ ਕਿੰਨਾ ਖਰਚਾ ਆਵੇਗਾ ਹੈ ਨਾ ਭਾਅ ਜੀ ਜੇ ਜਦੋਂ ਵੀ ਪਾਠ ਹੈਗਾ ਇਹ ਹੈਗਾ ਹੈ ਨੈਕਸਟ ਵੀਕ ਤੁਸੀਂ ਮੈਨੂੰ ਦੱਸ ਦਿਓ ਮੈਂ ਤੁਹਾਨੂੰ ਭਾਅ ਜੀ ਤੁਹਾਨੂੰ ਨੰਬਰ ਕੰਟੈਕਟ ਤੁਹਾਨੂੰ ਜ਼ਰੂਰ ਕੰਟੈਕਟ ਕਰੂੰਗਾ ਤੁਸੀਂ ਮੈਨੂੰ ਨਾ ਭਾਅ ਜੀ ਆਪਣਾ ਨੰਬਰ ਮੈਨੂੰ ਸਾਰੇ ਪੇਮੈਂਟ ਦੀ ਨਾਲ ਡਿਸਕਾਊਂਟ ਲਗਾ ਕੇ ਦੱਸ ਦਿਓ ਕਿੰਨਾ ਭਾਅ ਜੀ ਤੁਸੀਂ ਕਰ ਸਕਦੇ ਤੁਹਾਡਾ ਬਹੁਤ ਬਹੁਤ ਧੰਨਵਾਦ